ਦੇਖੋ ਜੀ ਹਰ ਇਨਸਾਨ ਦੀਆਂ ਆਪਣੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਹੁੰਦੀਆਂ ਮੇਰੀਆਂ ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਹੈ ਉਹ ਹੈ ਬੱਚੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ ਤਾਂ ਮੈਨੂੰ ਆਪਣੇ ਆਪ ਨੂੰ ਬਹੁਤ ਵੀਕ ਲੱਗਦਾ ਬਹੁਤ ਟੈਂਸ਼ਨ ਹੋ ਜਾਂਦੀ ਹੈ ਜ਼ਿਆਦਾ ਸੁਧ ਬੁਧ ਨਹੀਂ ਰਹਿੰਦੀ ਇਸ ਲਈ ਮੈਨੂੰ ਹੁੰਦਾ ਕਿ ਮੇਰੇ ਬੱਚੇ ਬਹੁਤ ਸਹੀ ਤਰੀਕੇ ਨਾਲ ਰਹਿਣ ਤੰਦਰੁਸਤ ਰਹਿਣ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੂਸਰੀ ਕਮਜ਼ੋਰੀ ਹੈ ਜੀ ਮੇਰੀ ਫੈਮਲੀ ਮੈਂਬਰਸ ਕਿਉਂਕਿ ਮੇਰੇ ਫੈਮਲੀ ਮੈਂਬਰਸ ਮੇਰੇ ਪੇਰੈਂਟਸ ਮੇਰੇ ਬ੍ਰਦਰ ਸਿਸਟਰ ਸਾਰੇ ਹੈ ਅਗਰ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਨਾਲ ਵੀ ਮੈਨੂੰ ਬਹੁਤ ਟੈਨਸ਼ਨ ਹੁੰਦੀ ਹੈ ਔਰ ਮੈਂ ਆਪਣੇ ਆਪ ਨੂੰ ਵੀਕ ਸਮਝਦੀ ਹਾਂ ਇੱਕ ਮੈਨੂੰ ਉੱਚਾਈ ਤੋਂ ਬਹੁਤ ਡਰ ਲੱਗਦਾ ਉੱਚਾਈ 'ਤੇ ਜਦੋਂ ਅਸੀਂ ਨੀਚੇ ਦੇਖਦੇ ਹਾਂ ਤਾਂ ਮੈਨੂੰ ਲੱਗਦਾ ਕਿ ਮੈਂ ਹੁਣੇ ਨੀਚੇ ਖੁਦ ਹੀ ਡਿੱਗ ਜਾਣਾ ਇਸ ਲਈ ਮੈਂ ਉੱਚਾਈ ਵਾਲਾ ਜ਼ਿਆਦਾ ਕੰਮ ਨਹੀਂ ਕਰਦੀ ਔਰ ਨਾ ਹੀ ਇੱਕ ਪਾਣੀ ਗਹਿਰੇ ਪਾਣੀ ਵਾਲਾ ਇੱਕ ਗਹਿਰਾ ਪਾਣੀ ਐਸਾ ਲੱਗਦਾ ਕਿ ਮੈਨੂੰ ਆਪਣੇ ਅੰਦਰ ਹੀ ਖਿੱਚ ਕੇ ਲੈ ਕੇ ਜਾ ਰਿਹਾ ਹੈ ਇਸ ਲਈ ਜ਼ਿਆਦਾ ਗਹਿਰਾਈ ਵਾਲਾ ਪਾਣੀ ਉੱਚਾਈ ਇਹ ਸਾਰੀ ਚੀਜ਼ਾਂ ਨੂੰ ਸਭ ਮੇਰੀ ਵੀਕਨੈਸ ਆ ਔਰ ਸ਼ਕਤੀਆਂ ਦੀ ਗੱਲ ਕਰੀਏ ਤਾਂ ਸ਼ਕਤੀਆਂ ਵੀ ਮੇਰੇ ਬੱਚੇ ਹੀ ਹਨ ਬੱਚੇ ਕਿ ਜਦੋਂ ਬੱਚੇ ਮੇਰੇ ਨਾਲ ਖੜ੍ਹੇ ਹੁੰਦਾ ਹੈ ਤਾਂ ਮੈਂ ਕੋਈ ਵੀ ਵੱਡੀ ਸਚੂਏਸ਼ਨ ਕੋਈ ਵੀ ਪ੍ਰੋਬਲਮ ਆ ਜਾਵੇ ਉਹਦਾ ਮੈਂ ਡਟ ਕੇ ਸਾਹਮਣਾ ਕਰ ਸਕਦੀ ਹਾਂ ਲਾਈਫ 'ਚ ਬੜੇ ਇਹੋ ਜਿਹੇ ਟਾਈਮ ਆਏ ਹੈ ਜਦੋਂ ਮੇਰੇ ਬੱਚਿਆਂ ਨੇ ਮੇਰਾ ਸਾਥ ਦਿੱਤਾ ਹੈ ਔਰ ਮੈਨੂੰ ਪੂਰੀ ਮੇਰੇ ਅੱਗੇ ਢਾਲ ਬਣ ਕੇ ਖੜ੍ਹੇ ਹੋਏ ਹੈ ਦੂਸਰੀ ਹੈ ਜੀ ਮੇਰੀ ਸ਼ਕਤੀ ਕਿ ਮੈਂ ਆਪਣੇ ਪੈਰਾਂ 'ਤੇ ਸਟੈਂਡ ਹਾਂ ਆਪਣੇ ਪੈਰਾਂ 'ਤੇ ਸਟੈਂਡ ਹੋਣ ਨਾਲ ਮੈਨੂੰ ਕਿਸੇ ਦੇ ਨਾਲ ਅੱਗੇ ਝੁਕਣਾ ਨਹੀਂ ਪੈਂਦਾ ਕਿਸੇ ਦੇ ਤਰਲੇ ਮਿੰਨਤਾਂ ਨਹੀਂ ਕਰਨੇ ਪੈਂਦੇ ਜਿਹਦੇ ਕਾਰਨ ਕਿ ਮੈਂ ਬਹੁਤ ਆਪਣੇ ਆਪ ਨੂੰ ਸਟਰੋਂਗ ਫੀਲ ਕਰਦੀ ਹਾਂ ਔਰ ਇੱਕ ਹੋਰ ਮੇਰੀ ਸ਼ਕਤੀ ਹੈ ਜੀ ਮੇਰੇ ਪੇਰੈਂਟਸ ਕਿਉਂਕਿ ਉਹਨਾਂ ਨੇ ਹਰ ਜਗ੍ਹਾ ਹਰ ਤਰੀਕੇ ਨਾਲ ਮੇਰਾ ਸਾਥ ਦਿੱਤਾ ਉਹਨਾਂ ਨੇ ਮੈਨੂੰ ਇਸ ਉਹ ਜਗ੍ਹਾ 'ਤੇ ਮੈਨੂੰ ਸਾਥ ਦਿੱਤਾ ਜਦੋਂ ਮੈਂ ਆਪਣਾ ਸਾਰਾ ਟੁੱਟ ਚੁੱਕੀ ਸੀ ਔਰ ਉਹਨਾਂ ਨੇ ਮੈਨੂੰ ਸਾਰਾ ਇੰਨਾ ਸਟਰੋਂਗ ਕੀਤਾ ਮੈਨੂੰ ਸਮਝਾਇਆ ਮੈਨੂੰ ਸਹੀ ਤਰੀਕੇ ਰਸਤੇ 'ਤੇ ਚੱਲਣਾ ਸਿਖਾਇਆ ਵੀ ਕਿਹੜਾ ਰਸਤਾ ਸਹੀ ਹੈ ਕਿਸ ਤਰ੍ਹਾਂ ਆਪਾਂ ਹੁਣ ਸਟਰੋਂਗ ਬਣ ਕੇ ਹਰ ਮੁਸ਼ਕਲ ਦਾ ਸਾਹਮਣਾ ਕਰਨਾ ਇਹ ਸਭ ਚੀਜ਼ਾਂ ਮੈਂ ਆਪਣੇ ਪੇਰੈਂਟਸ ਤੋਂ ਸਮਝੀ ਹਾਂ ਔਰ ਮੇਰੀ ਸਭ ਤੋਂ ਵੱਡੀ ਜਿਹੜੀ ਸ਼ਕਤੀ ਹੈ ਉਹ ਮੇਰੇ ਪੇਰੈਂਟਸ ਮੇਰੇ ਬੱਚੇ ਹੀ ਹੈ ਜਿਨ੍ਹਾਂ ਦੇ ਕਾਰਨ ਮੈਂ ਆਪਣੇ ਪੈਰਾਂ 'ਤੇ ਸਟੈਂਡ ਹਾਂ ਔਰ ਮੈਂ ਹਰ ਮੁਸ਼ਕਲ ਦਾ ਸਾਹਮਣਾ ਕਰ ਪਾ ਰਹੀ ਹਾਂ